ਰਿਚ ਡੈਡ ਪੂਅਰ ਡੈਡ ਕਿਤਾਬ ਰੋਬਰਟ ਕਿਯੋਸਾਕੀ ਦੁਆਰਾ ਲਿਖੀ ਗਈ ਹੈ ਇਸ ਕਿਤਾਬ ਵਿੱਚ ਕਿਯੋਸਾਕੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਆਪਣੇ ਜੀਵਨ ਦੇ ਦੋ ਮੂਲ ਕਿਰਦਾਰਾਂ ਨੂੰ ਪੇਸ਼ ਕੀਤਾ ਹੈ ਇਸ ਕਿਤਾਬ ਨੇ ਅਮੀਰੀ ਅਤੇ ਸਫਲਤਾ ਦੇ ਮੂਲ ਮਾਪਦੰਡ ਨੂੰ ਵਧਾਇਆ ਹੈ ਇਸ ਕਿਤਾਬ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕਿਵੇਂ ਆਪਣੇ ਜੀਵਨ ਵਿੱਚ ਉਤਾਰ ਚੜ੍ਹਾਅ ਕਰਕੇ ਆਪਣੇ ਜੀਵਨ ਨੂੰ ਮਜ਼ਬੂਤ ਬਣਾ ਸਕਦੇ ਹਨ ਇਸ ਵਿੱਚ ਉਹਨਾਂ ਨੇ ਦੱਸਿਆ ਗਿਆ ਹੈ ਕਿ ਸਿਰਫ ਧਨ ਹੀ ਨਹੀਂ ਬਲਕਿ ਅਨੁਭਵ ਅਤੇ ਸਿੱਖਿਆ ਜੀਵਨ ਦੇ ਅਸਲ ਮੋਲ ਹਨ ਇਹ ਕਿਤਾਬ ਬਹੁਤ ਹੀ ਸੋਚ ਉਕਸਾਉਣ ਵਾਲੀ ਹੈ ਜੋ ਕਿ ਸਾਡੇ ਜੀਵਨ ਨੂੰ ਬਦਲ ਸਕਦੀ ਹੈ ਮੈਂ ਅੱਜ ਤੱਕ ਕਿਸੇ ਵੀ ਕਿਤਾਬ ਰੀਡਿੰਗ ਕਲੱਬ ਵਿੱਚ ਸ਼ਾਮਿਲ ਨਹੀਂ ਹੋਈ ਕਿਉਂਕਿ ਅੱਜ ਤੱਕ ਮੈਨੂੰ ਉਸ ਵਿੱਚ ਜਾਣ ਦਾ ਮੌਕਾ ਨਹੀਂ ਮਿਲ ਸਕਿਆ